ਪਿੰਜਰੇ ਵਿੱਚ ਕੈਦ ਪੰਛੀ ਬਾਰੇ ਸਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਪੰਛੀ ਛੱਤਾਂ ਦੇ ਉੱਪਰ ਉੱਡਦੇ ਹੀ ਸੋਹਣੇ ਲੱਗਦੇ ਨੇ ਉੱਪਰ ਅਸਮਾਨ ਦੇ ਉੱਤੇ ਉੱਡਦੇ ਪੰਛੀ ਬਹੁਤ ਪਿਆਰੇ ਲੱਗਦੇ ਨੇ ਕਈ ਵਾਰੀ ਪੰਛੀ ਅਲੱਗ ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ ਕੋਲ ਆ ਕੇ ਖੇਡਣ ਲੱਗ ਜਾਂਦੇ ਤਾਂ ਬਹੁਤ ਪਿਆਰੇ ਲੱਗਦੇ ਆ ਪੰਛੀ ਪੰਛੀਆਂ ਨੂੰ ਆਜ਼ਾਦ ਕਰਨਾ ਬਹੁਤ ਚੰਗੀ ਗੱਲ ਆ ਪੰਛੀ ਪਿੰਜਰੇ ਦੇ ਵਿੱਚ ਬੰਦ ਨਹੀਂ ਕਰਨੇ ਚਾਹੀਦੇ ਇੱਕ ਵਾਰ ਦੀ ਇੱਕ ਵਾਰ ਦੀ ਘਟਨਾ ਹੈ ਕਿ ਮੇਰੇ ਦਾਦਾ ਜੀ ਨੇ ਇੱਕ ਪੰਛੀ ਨੂੰ ਤੋਤੇ ਨੂੰ ਬੰਦ ਕਰਿਆ ਹੋਇਆ ਸੀ ਜੋ ਕਿ ਸਾਡੇ ਘਰ ਵਿੱਚ ਹੀ ਰੱਖਿਆ ਹੋਇਆ ਸੀ ਉਸ ਨੂੰ ਮੈਂ ਚੂਰੀ ਪਾਉਣੀ ਉਸ ਦੀ ਬਹੁਤ ਸੇਵਾ ਕਰਨੀ ਪਰ ਇੱਕ ਦਿਨ ਮੇਰੇ ਮਨ ਵਿੱਚ ਆਇਆ ਕਿ ਇਸ ਨੂੰ ਕਿਉਂ ਨਾ ਆਜ਼ਾਦ ਕੀਤਾ ਜਾਵੇ ਆਜ਼ਾਦੀ ਦੇ ਨਾਲ ਹੀ ਪੰਛੀ ਚੰਗੇ ਲੱਗਦੇ ਨੇ ਤਾਂ ਮੈਂ ਕੀ ਕੀਤਾ ਚੁੱਪ ਕਰਕੇ ਉਹ ਪੰਛੀ ਨੂੰ ਛੱਡ ਦਿੱਤਾ ਤਾਂ ਮੇਰੇ ਬਹੁਤ ਝਿੜਕਾਂ ਪਈਆਂ ਮੈਨੂੰ ਬਹੁਤ ਮਤਲਬ ਅ ਅੱਜ ਵੀ ਮਾਣ ਮਹਿਸੂਸ ਹੁੰਦਾ ਕਿ ਮੈਂ ਆਪਣੇ ਆਪ ਉਸ ਪੰਛੀ ਨੂੰ ਉਡਾਇਆ ਸੀ ਪੰਛੀ ਇੱਕ ਕੋਇਲ ਕੂਕਦੀ ਸਾਨੂੰ ਬਹੁਤ ਚੰਗੀ ਲੱਗਦੀ ਆ ਜੇ ਕੋਈ ਗਰਮੀਆਂ ਦੇ ਦਿਨਾਂ ਵਿੱਚ ਆਉਂਦੀ ਹੈ ਕਈ ਪੰਛੀ ਹੁੰਦੇ ਆ ਸ਼ਾਮ ਨੂੰ ਆਉਂਦੇ ਆ ਅਤੇ ਫਿਰ ਰਾਤ ਨੂੰ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਨੇ ਉੱਡਦੇ ਹੋਏ ਪੰਛੀਆਂ ਦੀਆਂ ਡਾਰਾਂ ਬਹੁਤ ਚੰਗੀਆਂ ਲੱਗਦੀਆਂ ਨੇ